ਜਿਹੜੇ ਆ ਪੰਜਾਬ ਵਿੱਚ ਜਿੱਦਾਂ ਜਿਹੜੀਆਂ ਪ੍ਰਾਕਿਤਵ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਹੈਗੀਆਂ ਹਨ ਜਿਨ੍ਹਾਂ ਵਿੱਚ ਹੜ੍ਹ ਸੋਕਾ ਵਗੈਰਾ ਜਿੱਦਾਂ ਹੁਣ ਆਪਾਂ ਦੇਖਿਆ ਜਾ ਸਕਦਾ ਪਿੱਛੇ ਦੋ ਹਜ਼ਾਰ ਤੇਈ ਵਿੱਚ ਪੰਜਾਬ ਵਿੱਚ ਜਿਹੜਾ ਹੈਗਾ ਹੈ ਮੀਂਹ ਕਾਰਨ ਜਿਹੜਾ ਹੈਗਾ ਹੈ ਕਾਫ਼ੀ ਜ਼ਿਆਦਾ ਹੜ੍ਹ ਆਏ ਸੀਗੇ ਕਾਫ਼ੀ ਜ਼ਿਆਦਾ ਇੱਥੇ ਜਿਹੜਾ ਪੰਜਾਬ ਦਾ ਹੈਗਾ ਜਿਹੜਾ ਉਹ ਮਾਲੀ ਨੁਕਸਾਨ ਵੀ ਹੋਇਆ ਸੀਗਾ ਅਤੇ ਇਹਦੇ ਵਾਸਤੇ ਜਿਹੜੀਆਂ ਹੈਗੀਆਂ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਉਹ ਕਾਫ਼ੀ ਜ਼ਿਆਦਾ ਜਿਹੜੇ ਹੈ ਕਦਮ ਚੁੱਕ ਰਹੀ ਹੈਗੀ ਹੈ ਜਿਹਨਾਂ ਵਿੱਚ ਜਿੱਦਾਂ ਹੁਣ ਮੰਨ ਲਉ ਜਿੱਦਾਂ ਹੁਣ ਮੰਨ ਲਉ ਬਰਸਾਤ ਸੀਜਨ ਆ ਗਿਆ ਵਾ ਹੈਗਾ ਹੈ ਬਰਸਾਤ ਸੀਜਨ ਵਾਸਤੇ ਜਿੱਦਾਂ ਹੁਣ ਮੰਨ ਲਉ ਕਿਤੇ ਇੱਥੇ ਜਿਹੜਾ ਦਰਿਆ ਵਗੈਰਾ ਹੁੰਦਾ ਹੈਗਾ ਜਿਹੜੇ ਉੱਥੇ ਦੇ ਜਿਹੜੇ ਗੇਟ ਵਗੈਰਾ ਹੁੰਦੇ ਹੈਗੇ ਹੈ ਉਹ ਤੋਂ ਦੋ ਮਹੀਨੇ ਪਹਿਲਾਂ ਉਹ ਖੋਲ੍ਹਣੇ ਵਗੈਰਾ ਜਿਹੜੇ ਹੈਗੇ ਹੈ ਉਹ ਸਟਾਰਟ ਵਗੈਰਾ ਕਰ ਦਿੰਦੇ ਹੈਗੇ ਤਾਂ ਜੋ ਉਨ੍ਹਾਂ ਨੂੰ ਜਿਹੜੀ ਹੈਗੀ ਹੈ ਰਿਪੇਅਰ ਵਗੈਰਾ ਜੇ ਕੋਈ ਮੈਂਟੀਨੰਸ ਦੀ ਲੋੜ ਹੈਗੀ ਹੈ ਤਾਂ ਉਹਨਾਂ ਨੂੰ ਜਿਹੜਾ ਹੈਗਾ ਹੈ ਉਹ ਦੇਖਿਆ ਜਾ ਸਕੇ ਸਰਕਾਰ ਉਹਦੇ ਵਾਸਤੇ ਪਹਿਲੇ ਜਿਹੜੇ ਮਹਿਕਮੇ ਨੂੰ ਇੰਟ ਇੰਸਟਕਸ਼ਨ ਵਗੈਰਾ ਦੇ ਦਿੰਦੀ ਹੈਗੀ ਜਿਹੜਾ ਇਸ ਤੋਂ ਇਲਾਵਾ ਵਗੈਰਾ ਹੁੰਦੀਆਂ ਹੈਗੀਆਂ ਹੈ ਜਿੱਦਾਂ ਹੁਣ ਮੰਨ ਲਉ ਜਿਹੜੇ ਦਰਿਆ ਹੈਗੇ ਹੈ ਜਿੱਦਾਂ ਪਿੰਡ ਦੇ ਜਿਹੜੇ ਸੂਏ ਵਗੈਰਾ ਹੁੰਦੇ ਹੈਗੇ ਹੈ ਉਹ ਜਿਹੜੇ ਉੱਥੇ ਜਿਹੜੇ ਉਹਦੇ ਕੰਢੇ ਵਗੈਰਾ ਹੁੰਦੇ ਜਿਹੜੇ ਕਿਨਾਰੇ ਵਗੈਰਾ ਹੁੰਦੇ ਹੈਗੇ ਹੈ ਉਨ੍ਹਾਂ ਨੂੰ ਜਿਹੜੀ ਹੈਗੀ ਹੈ ਸਰਕਾਰ ਪਹਿਲਾਂ ਜਿਹੜੀ ਹੈਗੀ ਹੈ ਆਪਣੇ ਜ਼ਿਲ੍ਹੇ ਦੇ ਅਧਾਰ 'ਤੇ ਆਪਣੀ ਜਿੱਦਾਂ ਵੀ ਆਪਣੀ ਜਿਹੜੀ ਟੀਮ ਵਗੈਰਾ ਬਣਾਈ ਵੀ ਹੁੰਦੀ ਹੈਗੀ ਹੈ ਉਨ੍ਹਾਂ ਨੂੰ ਉਹ ਕਹਿ ਕੇ ਉਨ੍ਹਾਂ ਨੂੰ ਜਿਹੜੇ ਕੰਢੇ ਵਗੈਰਾ ਹੈਗੇ ਹੈ ਉਨ੍ਹਾਂ ਨੂੰ ਡੰਗੇ ਲਾਉਣ ਦਾ ਕੰਮ ਉਨ੍ਹਾਂ ਨੂੰ ਜਿਹੜਾ ਹੈਗਾ ਪੱਕਾ ਕਰਨ ਦਾ ਕੰਮ ਜਿੱਦਾਂ ਹੁਣ ਜੇ ਪੱਕਾ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਜਿੱਦਾਂ ਕੰਢਿਆਂ 'ਤੇ ਬੋਰੀਆਂ ਵਗੈਰਾ ਲਾ ਦਿੱਤੀਆਂ ਜਾਂਦੀਆਂ ਕੰਢਿਆਂ 'ਤੇ ਬੂਟੇ ਵਗੈਰਾ ਲਾ ਦਿੱਤੇ ਜਾਂਦੇ ਹੈਗੇ ਹੈ ਤਾਂ ਜੋ ਜਿਹੜਾ ਹੈਗਾ ਹੈ ਮਤਲਬ ਕੰਢੇ ਵਗੈਰਾ ਟੁੱਟਣ ਨਾ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਜਿੱਦਾਂ ਹੁਣ ਕੋਈ ਦੁਰਘਟਨਾਵਾਂ ਜਿੱਦਾਂ ਸੋਕਾ ਵਗੈਰਾ ਪੈਂਦਾ ਹੈਗਾ ਹੈ ਸੋਕੇ ਵਾਸਤੇ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਉਹ ਜਿਹੜੀਆਂ ਉਹਦੇ ਬਾ ਉਹਦੇ ਨਾਲ ਨਜਿੱਠਣ ਵਾਸਤੇ ਜਿੱਦਾਂ ਉਹ ਕਹਿ ਸਕਦੇ ਹੈਗੇ ਹੈ ਵੀ ਜਿ ਜਿਹੜੀਆਂ ਫ਼ਸਲਾਂ ਨੂੰ ਜਿਹੜਾ ਪਾਣੀ ਘੱਟ ਲੱਗਦਾ ਹੈਗਾ ਹੈ ਹੈਂਅ ਉਹ ਫ਼ਸਲਾਂ ਜਿਹੜੇ ਹੈਗੀ ਸਰਕਾਰ ਉਨ੍ਹਾਂ ਨੂੰ ਬੀਜਣ ਵਾਸਤੇ ਉਨ੍ਹਾਂ ਦੀ ਮਤਲਬ ਪੈਦਾਵਾਰ 'ਤੇ ਜ਼ਿਆਦਾ ਮਤਲਬ ਜ਼ੋਰ ਦੇ ਰਹੀ ਹੈਗੀ ਹੈ ਤਾਂ ਜੋ ਜਿਹੜਾ ਹੈਗਾ ਪੰਜਾ ਪਾਣੀ ਜਿਹੜਾ ਹੈਗਾ ਹੈ ਉਹ ਪਾਣੀ ਦੀ ਵਰਤੋਂ ਘੱਟ ਹੋਵੇ ਅਤੇ ਲੋਕਾਂ ਦਾ ਜਿਹੜਾ ਹੈਗਾ ਹੈ ਇਕਨੋਮੀਕਲੀ ਜਾਂ ਫਾਇਨੈਸ਼ਿਅਲੀ ਜਿਹੜਾ ਹੈਗਾ ਪ੍ਰੋਫਿਟ ਉਹ ਜ਼ਿਆਦਾ ਕ ਲੈ ਸਕਣ